ਰੇਹੂ ਮਛਲੀ ਕਤਲਾ ਸਿਲਵਰ ਕੋਪਰ ਇਹ ਮੇਰੀਆਂ ਮਨਪਸੰਦ ਮੱਛੀਆਂ ਏ ਇ ਇਹਨਾਂ ਨੂੰ ਆਮ ਤੌਰ 'ਤੇ ਲੋਕ ਖਾਣਾ ਪਸੰਦ ਕਰਦੇ ਹੈ ਅਤੇ ਇਹਨਾਂ ਵਿਚੋਂ ਜ਼ਿਆਦਾ ਸਿਲਵਰ ਕੋਪਰ ਮੱਛੀ ਨੂੰ ਲੋਕ ਖਾਣਾ ਪਸੰਦ ਕਰਦੇ